ਸਿਹਤ ਸੰਬੰਧੀ ਸਰਕਾਰੀ ਸਕੀਮਾਂ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਇਸ ਸਕੀਮ ਦੇ ਥਰੂ ਮਤਲਬ ਕਿ ਜੇ ਕਿਸੀ ਵੀ ਵਿਅਕਤੀ ਦਾ ਜਿਨ੍ਹਾਂ ਨੇ ਮਤਲਬ ਕਿ ਬੀਮਾ ਕਰਵਾਇਆ ਪ੍ਰਧਾਨ ਮੰਤਰੀ ਜੀਵਨ ਬੀਮਾ ਯੋਜਨਾ ਇਹ ਸਕੀਮ ਦਾ ਲਾਭ ਲਿਆ ਹੈ ਉਨ੍ਹਾਂ ਵਿਅਕਤੀਆਂ ਉਨ੍ਹਾਂ ਜਿਹੜੇ ਵਿਅਕਤੀ ਦਾ ਮਤਲਬ ਕਿ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਹੋ ਜਾਵੇ ਜਾਂ ਫਿਰ ਰੋਡ ਸਾਈਡ ਰੋਡ ਸਾਈਡ ਐਕਸੀਡੈਂਟ ਹੋ ਜਾਵੇ ਜਾਂ ਫਿਰ ਸਰੀਰ ਦਾ ਕੋਈ ਅੰਗ ਕੱਟ ਜਾਵੇ ਤਾਂ ਸਰਕਾਰ ਵੱਲੋਂ ਇਸ ਸਕੀਮ ਦੇ ਥਰੂ ਉਨ੍ਹਾਂ ਨੂੰ ਇੱਕ ਲੱਖ ਇੱਕ ਲੱਖ ਰੁਪਇਆ ਦਿੱਤਾ ਜਾਂਦਾ ਹੈ ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ ਪ੍ਰਧਾਨ ਮੰਤਰੀ ਸੁਰੱਕਸ਼ਾ ਇਸ ਸਕੀਮ ਵਿੱਚ ਜੇਕਰ ਕਿਸੇ ਵਿਅਕਤੀ ਦਾ ਐਕਸੀਡੈਂਟ ਹੋ ਕੇ ਦੈੱਥ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਦੋ ਲੱਖ ਦਿੱਤਾ ਜਾਂਦਾ ਹੈ ਆਯੂਸ਼ਮਾਨ ਕਾਰਡ ਆਯੂਸ਼ਮਾਨ ਕਾਰਡ ਆਯੂਸ਼ਮਾਨ ਕਾਰਡ ਵਿੱਚ ਪੰਜ ਲੱਖ ਤੱਕ ਦਾ ਇਲਾਜ ਆਯੂਸ਼ਮਾਨ ਕਾਰਡ ਸਰਕਾਰੀ ਹੋਸਪਿਟਲਾਂ ਵਿੱਚ ਵੀ ਸਰਕਾਰੀ ਹਸਪਤਾਲਾਂ ਵਿੱਚ ਚੱਲ ਜਾਂਦਾ ਹੈ ਇਸ ਕਾਰਡ ਦੇ ਇਸ ਕਾਰਡ ਦੇ ਥਰੂ ਅਸੀਂ ਆਪਣਾ ਪੰਜ ਪੰਜ ਲੱਖ ਤੱਕ ਦਾ ਇਲਾਜ ਮੁਫਤ ਕਰਵਾ ਸਕਦੇ ਹਨ ਹੋਸਪਿਟਲ ਵਿੱਚ ਜੱਚਾ ਬੱਚਾ ਸਕੀਮ ਚਲਾਈ ਗਈ ਹੈ ਬੱਚੇ ਜਿਵੇਂ ਕਿ ਹੋਸਪਿਟਲ ਵਿੱਚ ਜੱਚਾ ਬੱਚਾ ਸਕੀਮ ਚਲਾਈ ਗਈ ਹੈ ਬੱਚੇ ਪੰਜ ਲੱਖ ਤੱਕ ਦਾ ਮਤਲਬ ਕਿ ਇਲਾਜ ਫ੍ਰੀ ਕਰਵਾ ਸਕਦੇ ਹਾਂ ਅਤੇ ਕਿਸੇ ਬਿਮਾਰੀ ਦਾ ਓਪਰੇਸ਼ਨ ਵਗੈਰਾ ਮਤਲਬ ਕਿ ਜੇ ਕੋਈ ਵੀ ਐਕਸੀਡੈਂਟ ਹੋ ਜਾਵੇ ਕੋਈ ਵੀ ਬਿਮਾਰੀ ਦਾ ਓਪਰੇਸ਼ਨ ਕਰਵਾਉਣਾ ਹੋਵੇ ਮਤਲਬ ਕਿ ਗਰੀਬ ਪਰਿਵਾਰ ਤੋਂ ਉਨ੍ਹਾਂ ਦਾ ਆਯੂਸ਼ਮਨ ਕਾਰਡ ਬਣਿਆ ਹੁੰਦਾ ਅਸੀਂ ਇਸ ਦੇ ਥਰੂ ਉਨ੍ਹਾਂ ਦਾ ਪੰਜ ਲੱਖ ਤੱਕ ਦਾ ਇਲਾਜ ਬਿਲਕੁਲ ਮੁਫਤ ਕਰਵਾ ਸਕਦੇ ਹਾਂ